ਭਾਰਤ ਵਿੱਚ ਬਹੁਤ ਸਾਰੇ ਵਪਾਰੀ ਉਦਯੋਗਪਤੀ ਅਤੇ ਨੇਤਾ ਹਨ ਜਿਨ੍ਹਾਂ ਨੇ ਭਾਰਤ ਦੀ ਸ਼ਾਨੋ ਸ਼ੌਕਤ ਨੂੰ ਚਾਰ ਚੰਦ ਲਗਾਏ ਹਨ ਅਤੇ ਇਸ ਦੀ ਉੱਨਤੀ ਵਿੱਚ ਸਹਾਇਕ ਹੋਏ ਹਨ ਇਹਨਾਂ ਵਿੱਚੋਂ ਇੱਕ ਹਨ ਸ਼੍ਰੀ ਮੁਕੇਸ਼ ਅੰਬਾਨੀ ਜੋ ਕਿ ਭਾਰਤ ਦੇ ਪ੍ਰਮੁੱਖ ਉਦਯੋਗ ਪਤੀ ਹਨ ਅਤੇ ਉਹ ਭਾਰਤ ਦੇ ਪਹਿਲੇ ਨੰਬਰ 'ਤੇ ਅਮੀਰ ਵਿਅਕਤੀ ਹਨ ਉਹਨਾਂ ਦੁਆਰਾ ਸ਼ੁਰੂ ਕੀਤਾ ਗਿਆ ਨੈੱਟਵਰਕ ਜੀਓ ਅੱਜ ਬੱਚੇ ਬੱਚੇ ਦੀ ਜੁਬਾਨ 'ਤੇ ਹੈ ਮੁਕੇਸ਼ ਅੰਬਾਨੀ ਨੇ ਸਾਰੇ ਭਾਰਤ ਨੂੰ ਡਿਜੀਟਲ ਬਣਾਉਣ ਲਈ ਜੀਓ ਦਾ ਨੈੱਟਵਰਕ ਸ਼ੁਰੂ ਕੀਤਾ ਅਤੇ ਸਾਰੇ ਲੋਕਾਂ ਨੂੰ ਪਹਿਲਾਂ ਇਹ ਨੈੱਟ ਮੁਫ਼ਤ ਮੁਹੱਈਆ ਕਰਵਾਇਆ ਅਤੇ ਅੱਜ ਇਹ ਸਭ ਲੋਕਾਂ ਵਿੱਚ ਹਰਮਨ ਪਿਆਰਾ ਹੈ ਇਸ ਨੈੱਟਵਰਕ ਦੀ ਸਪੀਡ ਵੀ ਦੂਸਰੇ ਨੈੱਟਵਰਕ ਤੋਂ ਬਹੁਤ ਜ਼ਿਆਦਾ ਹੈ ਇਸ ਨੇ ਭਾਰਤ ਦੀ ਤਰੱਕੀ ਵਿੱਚ ਸ਼ਲਾਂਘਾਯੋਗ ਯੋਗਦਾਨ ਪਾਇਆ ਹੈ